ਸਾਡੇ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਹਾਂਮਾਰੀ ਆਉਣਾ ਕੋਈ ਬਿਮਾਰੀ ਨਹੀਂ ਸਗੋਂ ਇਹ ਤਾਂ ਦਾਤ ਹੈ ਜਿਸ ਕਰਕੇ ਗੁਰੂ ਪੀਰ ਅਤੇ ਪੈਗੰਬਰ ਪੈਦਾ ਹੋਏ ਜੇ ਮਹਾਂਮਾਰੀ ਨਾ ਹੁੰਦੀ ਤਾਂ ਸਮਾਜ ਦੀ ਸਿਰਜਣਾ ਵੀ ਨ ਨਾਮੁਮਕਿਨ ਹੁੰਦੀ ਮਹਾਂਵਾਰੀ ਦੌਰਾਨ ਦੂਜੇ ਧਰਮਾਂ ਵਿੱਚ ਤਾਂ ਔਰਤਾਂ ਨੂੰ ਘਰ ਤੋਂ ਬਾਹਰ ਵੀ ਬਿਠਾ ਦਿੱਤਾ ਜਾਂਦਾ ਹੈ ਕਿ ਇਹ ਜੂਠੀ ਹੈ ਪਰ ਸਾਡੇ ਗੁਰੂ ਸਾਹਿਬਾਂ ਨੇ ਇਸਨੂੰ ਕਿਹਾ ਮਾਤ ਭੀ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੈ ਇਸ ਨੂੰ ਕੋਈ ਜੂਠਾ ਨਹੀਂ ਕਿਹਾ ਸਗੋਂ ਕਿਹਾ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਨਾਰੀ ਨੂੰ ਤਾਂ ਰਾਜਿਆਂ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਅਤੇ ਹੋਰ ਕਿਹਾ ਜੋ ਜੋ ਰੁਸਣ ਨਾਮ ਨੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਇ ਖੁਆਰ ਸੂਚੇ ਏਹ ਨਾ ਆਖੀਅਹਿ ਬਹਨਿ ਜਿ ਪਿੰਡਾ ਧੋਇ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਇ ਕਿ ਜੂਠਾ ਇਹ ਨਹੀ ਬਲਕਿ ਉਹ ਹੈ ਜੋ ਅੰਦਰ ਹੋਣਾ ਚਾਹੀਦਾ ਜੂਠਾ ਸਾਡੇ ਅੰਦਰ ਦੀ ਮੈਲ ਹੈ ਸਾਡਾ ਅੰਦਰ ਸਾਫ਼ ਹੋਣਾ ਜ਼ਰੂਰੀ ਹੈ ਔਰਤਾਂ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ ਪਰ ਅੱਜ ਕੱਲ੍ਹ ਕਿਉਂਕਿ ਨਵਾਂ ਵਰਗ ਹੈ ਕੁਝ ਪੜ੍ਹਨ ਲਿਖਣ ਕਾ ਸਦਕਾ ਅਤੇ ਕੁਝ ਮੀਡੀਆ ਦੇ ਪ੍ਰਭਾਵ ਸਦਕਾ ਅੱਗੇ ਨਾਲੋਂ ਕੁਝ ਜਾਗਰੂਕਤਾ ਹੋਇਆ ਜਾਗਰੂਕ ਤਾਂ ਹੋਇਆ ਹੀ ਹੈ ਅਤੇ ਇਸ ਬਾਰੇ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਇਹ ਇਹਨਾਂ ਦਿਨਾਂ ਵਿੱਚ ਅਸੀਂ ਆਪਣੀ ਸਾਫ਼ ਸਫਾਈ ਦਾ ਕਿਵੇਂ ਧਿਆਨ ਰੱਖਣਾ ਹੈ ਅਤੇ ਕਿਨ੍ਹਾਂ ਚੀਜ਼ਾਂ ਦੀ ਜ ਵਰਤੋਂ ਕਰਨੀ ਹੈ